ਸਾਡੇ ਘਰ ਦੇ ਆਲੇ ਦੁਆਲੇ ਦੇ ਇਲਾਕਿਆਂ ਨੂੰ ਸਾਫ ਸੁਥਰਾ ਰੱਖਣ ਲਈ ਅਸੀਂ ਬਹੁਤ ਸਾਰੇ ਉਪਾਅ ਕਰ ਸਕਦੇ ਹਾਂ ਜਿਵੇਂ ਕਿ ਅਸੀਂ ਡਸਟਬੀਨ ਜਿਹੜਾ ਹੈਗਾ ਉੱਥੇ ਉਪਲਬਧ ਕਰਵਾ ਸਕਦੇ ਹਾਂ ਆਲੇ ਦੁਆਲੇ ਦੇ ਕਿ ਜਿਹੜੇ ਲੋਕ ਨੇ ਉੱਥੇ ਹੈ ਵੀ ਇੱਕ ਡਸਟਬੀਨ ਦੇ ਵਿੱਚ ਇੱਕ ਆਪਣਾ ਕੂੜਾ ਕਰਕਟ ਜਮ੍ਹਾਂ ਕਰ ਸਕਦੇ ਨੇ ਅਤੇ ਸਰਕਾਰ ਦੁਆਰਾ ਟਵਿੰਨ ਵਿੰਨ ਜਿਹੜਾ ਇਹ ਨਵੀਂ ਇੱਕ ਟੈਕਨੋਲਜੀ ਲਾਈ ਜਾ ਰਹੀ ਇਹਦਾ ਸਰਦਾ ਉਪਯੋਗ ਵੀ ਕਰ ਸਕਦੇ ਨੇ